ਸਾਡੇ ਪੰਜਾਬ ਦੇ ਵਿੱਚ ਸੱਭਿਆਚਾਰਕ ਜਿਹੜੇ ਮੁੱਖ ਤੱਤ ਰਹਿੰਦੇ ਹਨ ਸਾਡੀ ਪੰਜਾਬ ਬੋਲੀ ਗਿੱਧਾ ਭੰਗੜਾ ਖਾਣਾ ਇੱਥੋਂ ਦੇ ਸ਼ਬਦ ਕੀਰਤਨ ਤੋਂ ਲੈ ਕੇ ਗੁਰਦੁਆਰਿਆਂ ਤੱਕ ਇਹ ਸਭ ਸੱਭਿਆਚਾਰਕ ਦੇ ਵਿੱਚ ਹੀ ਆਉਂਦਾ ਹੈ ਜਿਸ ਤਰ੍ਹਾਂ ਅਸੀਂ ਇੱਥੋਂ ਦੇ ਗਿੱਧੇ ਦੀ ਗੱਲ ਕਰੀਏ ਭੰਗੜੇ ਦੀ ਗੱਲ ਕਰੀਏ ਇਹ ਇੰਟਰਨੈਸ਼ਨਲ ਲੈਵਲ ਤੱਕ ਕਾਫ਼ੀ ਫੇਮਸ ਹਨ ਇਨ੍ਹਾਂ ਨੂੰ ਲੈ ਕੇ ਕਾਫ਼ੀ ਹੱਦ ਤੱਕ ਮੁਕਾਬਲੇ ਹੁੰਦੇ ਹਨ ਜਿਹਦੇ ਵਿੱਚ ਪੰਜਾਬ ਨੂੰ ਕਾਫ਼ੀ ਕਾਫ਼ੀ ਹੱਦ ਤੱਕ ਪਿਆਰ ਦਿੱਤਾ ਜਾਂਦਾ ਹੈ ਇਸ ਚੀਜ਼ ਨੂੰ ਲੈ ਕੇ ਅਤੇ ਅਸੀਂ ਅਗਰ ਲੰਗਰ ਦੀ ਗੱਲ ਕਰੀਏ ਲੰਗਰ ਜੋ ਪੰਜਾਬ ਤੋਂ ਸ਼ੁਰੂ ਹੋਇਆ ਇਹ ਇੰਟਰਨੈਸ਼ਨਲ ਲੈਵਲ ਤੱਕ ਲੰਗਰ ਲਾਏ ਜਾਂਦੇ ਹਨ ਲੋੜਵੰਦ ਲੋਕਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ ਜਿਹੜੇ ਵਿਚਾਰੇ ਬੇਰੁਜ਼ਗਾਰ ਨੇ ਉਨ੍ਹਾਂ ਨੂੰ ਰੋਟੀ ਮਿਲ ਜਾਂਦੀ ਹੈ ਗੁਰਦੁਆਰਿਆਂ ਵਿੱਚ ਇਹ ਲੰਗਰ ਪ੍ਰਥਾ ਬੜੇ ਵਧੀਆ ਤਰੀਕੇ ਨਾਲ ਚਲਾਉਂਦੇ ਨੇ ਅਤੇ ਜੇ ਅਸੀਂ ਬਾਹਰ ਵੀ ਗੱਲ ਕਰੀਏ ਤਾਂ ਲੋਕ ਲੰਗਰ ਲਗਾ ਕੇ ਆਪਣਾ ਵਧੀਆ ਤਰੀਕੇ ਨਾਲ ਲੋਕਾਂ ਨੂੰ ਭੋਜਨ ਛਕਾਉਂਦੇ ਆ ਅਤੇ ਦਿਲਾਂ ਨੂੰ ਤਸੱਲੀ ਵੀ ਹੁੰਦੀ ਹੈ ਅਤੇ ਇਹ ਸੱਭਿਆਚਾਰਕ ਤੱਤ ਜੋ ਵਧੀਆ ਵੀ ਲੱਗਦੇ ਨੇ ਧੰਨਵਾਦ